ਸਤਿ ਸ਼੍ਰੀ ਅਕਾਲ ਜੇਕਰ ਮੈਂ ਕੋਈ ਐਪ ਬਣਾਵਾਂਗੀ ਤਾਂ ਮੈਂ ਐਪ ਬਣਾਵਾਂਗੀ ਜਿਹਦੇ ਵਿੱਚ ਗਾਏ ਅਲਵਾਰਸ ਲਵਾਰਿਸ ਜਿਹੜੇ ਜਾਨਵਰ ਆ ਉਹਨਾਂ ਦੀ ਮਦਦ ਮਦਦ ਹੋਵੇ ਅਤੇ ਜਿੱਦਾਂ ਕਿ ਕੋਈ ਵੀ ਮਤਲਬ ਗਾਈਂ ਜਾਂ ਗਾਈਂ ਜਾਂ ਕੋਈ ਵੀ ਲਵਾਰਸ ਜਿਹੜਾ ਜਾਨਵਰ ਆ ਉਹ ਕਿਤੇ ਵੀ ਰੋਡ ਵਿੱਚ ਘੁੰਮਦਾ ਹੋਵੇ ਤਾਂ ਅਸੀਂ ਉਸ ਐਪ ਦੇ ਰਾਹੀਂ ਉਹਦੀ ਫੋਟੋ ਖਿੱਚ ਕੇ ਆਪਣੇ ਐਪ ਵਿੱਚ ਪਾ ਕੇ ਆਪਣੀ ਟੀਮ ਨੂੰ ਬੋਲਾਂਗੇ ਕਿ ਤੂੰ ਅ ਅ ਮਤਲਬ ਆਪਣੀ ਟੀਮ ਨੂੰ ਬੋਲਾਂਗੇ ਕਿ ਤੁਸੀਂ ਇਹ ਜਾਨਵਰ ਦੀ ਦੇਖਭਾਲ ਕਰੋ ਅਤੇ ਉਸ ਨੂੰ ਅਸੀਂ ਆਪਣੇ ਐਪ ਰਾਹੀਂ ਐਪ ਦੇ ਰਾਹੀਂ ਉਹਨੂੰ ਅ ਦੇਖਭਾਲ ਕਰਾਂਗੇ ਅਤੇ ਦੂਜੀ ਐਪ ਅਸੀਂ ਇੱਕ ਬਣਾ ਸਕਦੇ ਹਾਂ ਜਿਹਦੇ ਵਿੱਚ ਅਸੀਂ ਕਿਸੇ ਗਰੀਬ ਬੰਦੇ ਦੀ ਮਦਦ ਕਰ ਸਕਦੇ ਹਾਂ ਜੇ ਸਾਨੂੰ ਕਿਤੇ ਵੀ ਕੋਈ ਭਿਖਾਰੀ ਜਾਂ ਕੁਛ ਵੀ ਕੋਈ ਮੰਗਦਾ ਦਿਸ ਦਿਖਾਈ ਦੇਵੇ ਤਾਂ ਅਸੀਂ ਉਸ ਆਪਣੀ ਟੀਮ ਨੂੰ ਬੋਲ ਕੇ ਉਹਦਾ ਉਹਦਾ ਉਹਦਾ ਮਤਲਬ ਫੋਟੋ ਖਿੱਚ ਕੇ ਉਹਨਾਂ ਨੂੰ ਭੇਜ ਸਕਨੇ ਹਾਂ ਅਤੇ ਅਤੇ ਉਹਨਾਂ ਨੂੰ ਨਵੇਂ ਕੱਪੜੇ ਕੁਛ ਅੱਛਾ ਜੇ ਛੋਟੇ ਛੋਟੇ ਬੱਚੇ ਹੈ ਤਾਂ ਉਹਨਾਂ ਨੂੰ ਅਸੀਂ ਸਕੂਲ ਸਕੂਲ ਦੀ ਐਜੂਕੇਸ਼ਨ ਪ੍ਰੋਵਾਈਡ ਕਰਾਵਾਂਗੇ ਅਤੇ ਉਹਨਾਂ ਨੂੰ ਅਸੀ ਬ ਨਵੇਂ ਨਵੇਂ ਸ ਕੱਪੜੇ ਵੀ ਦਿਲਾਵਾਂਗੇ